ਇਸ ਖੇਤਰ ਦੇ ਲੋਕ ਆਪਣੇ ਧਰਮ ਨੂੰ ਲਿਖਤੀ ਰੂਪ ਵਿੱਚ ਜਿਹੜੇ ਆਪਣੇ ਪ੍ਰਚਾਰਕ ਨੇ ਉਹ ਸਮਾਗਮ ਵੀ ਕਰਵਾਉਂਦੇ ਨੇ ਬਾਕੀ ਗੁਰਦੁਆਰੇ ਪੰਜਾਬ ਵਿੱਚ ਪੰਜਾਬ ਤੋਂ ਬਾਹਰ ਬਹੁਤ ਸਾਰੇ ਨੇ ਉਹਨਾਂ ਦੇ ਦਰਸ਼ਨ ਕਰਵਾਉਂਦੇ ਹੈ ਉਹਨਾਂ ਦੇ ਉਹਨਾਂ ਬਾਰੇ ਦੱਸਦੇ ਹੈ ਕਿ ਕਿਹੜਾ ਗੁਰਦੁਆਰਾ ਕਿਹੜੇ ਗੁਰੂ ਨਾਲ ਅਤੇ ਇੱਥੇ ਕੀ ਹੋਇਆ ਸੀਗਾ ਇਸ ਤਰੀਕੇ ਨਾਲ ਜੋ ਆਉਣ ਵਾਲੀ ਪੀੜ੍ਹੀ ਹੈ ਉਹਨੂੰ ਆਪਣਾ ਇਹ ਧਰਮ ਬਾਰੇ ਪਤਾ ਲੱਗਦਾ ਹੈ ਅਤੇ ਕਿੱਦਾਂ ਚੱਲਣਾ ਹੈ ਉਸ ਨੂੰ ਦੱਸਿਆ ਜਾਂਦਾ ਹੈ ਤੁਸੀਂ ਗੁਰਦੁਆਰੇ ਜਾਓ ਉੱਥੇ ਕਿੱਦਾਂ ਦਾ ਵਾਤਾਵਰਨ ਹੈ ਕਿੱਦਾਂ ਉੱਥੇ ਲੰਗਰ ਛਕਾਇਆ ਜਾਂਦਾ ਹੈ ਕਿੱਦਾਂ ਤਿਆਰ ਹੁੰਦਾ ਹੈ ਇਹ ਸਭ ਚੀਜ਼ਾਂ ਜਾਂ ਤਾਂ ਤੁਸੀਂ ਨਾਲ ਲੈ ਕੇ ਜਾਓ ਆਉਣ ਵਾਲੀ ਪੀੜ੍ਹੀ ਨੂੰ ਤਾਂ ਪਤਾ ਲੱਗਦਾ ਹੈ ਜਾਂ ਬਾਣੀ ਵਿੱਚ ਵੀ ਕਾਫੀ ਕੁਛ ਲਿਖਿਆ ਹੈ ਬਾਣੀ ਪੜ੍ਹੋ ਸਿੱਖੋ ਇਹਨਾਂ ਚੀਜ਼ਾਂ ਤੋਂ ਤੁਹਾਨੂੰ ਆਪਣਾ ਜਿਹੜਾ ਪਿੱਛੇ ਦਾ ਕਿੱਥੋਂ ਧਰਮ ਕਿੱਦਾਂ ਚੱਲਿਆ ਇਹ ਸਭ ਕੁਛ ਪਤਾ ਲੱਗਦਾ ਹੈ